ਹੈਲੋ ਨਮਸਕਾਰ ਜੀ ਨਰੇਸ਼ ਬੋਲ ਰਿਹਾ ਅੱਜ ਮੈਂ ਗੱਲ ਕਰਾਂਗਾ ਜੀ ਆਪਣੇ ਅਨੁਵਾਦ ਦੀ ਮੈਂ ਇੱਕ ਵਾਰੀ ਕ ਕ ਕੰਪੀਟੀਸ਼ਨ 'ਚ ਗਿਆ ਉੱਥੇ ਮੈਨੂੰ ਪੰਜਾਬੀ ਦੇ ਵਿੱਚ ਮੌਕਾ ਮਿਲਿਆ ਬੋਲਣ ਦਾ ਕਿ ਕਿਸੇ ਚੀਜ਼ ਬਾਰੇ ਬੋਲਾਂ ਅਨੁਵਾਦ ਕਰਾਂ ਮੈਂ ਪੰਜਾਬੀ ਸੱਭਿਆਚਾਰਕ ਬਾਰੇ ਬੋਲਿਆ ਸੱਭਿਆਚਾਰਕ ਖੇਡਾਂ ਬਾਰੇ ਖ ਸੱਭਿਆਚਾਰਕ ਪ੍ਰੋਗਰਾਮ ਵਗੈਰਾ ਸੱਭਿਆਚਾਰਕ ਸੱਭਿਆਚਾਰਕ ਮੇਲੇ ਬਾਰੇ ਬੋਲਿਆ ਮੈਂ ਉੱਥੇ ਬੜਾ ਵਧੀਆ ਲੱਗਿਆ ਮੈਨੂੰ ਥੋੜ੍ਹਾ ਨਰਵਸ ਵੀ ਮਹਿਸੂਸ ਹੋ ਰਿਹਾ ਸੀ ਅਤੇ ਬਹੁਤ ਵਧੀਆ ਲੱਗਿਆ ਮੈਨੂੰ ਚੰਗਾ ਲੱਗਿਆ ਹਾਵ ਭਾਵ ਵੀ ਬੜੇ ਜ਼ੋਰ ਸ਼ੋਰ ਨਾਲ ਚੰਗੀ ਤਰ੍ਹਾਂ ਬੋਲਿਆ ਬਹੁਤ ਲੋਕਾਂ ਨੂੰ ਦੁਨੀਆ ਨੂੰ ਬਹੁਤ ਪਸੰਦ ਆਇਆ ਮੇਰਾ ਇੱਕ ਤਾਂ ਅਨੁਭਵ ਵਧਿਆ ਮੇਰਾ ਉਹਦੇ ਨਾਲ ਬੋਲਣ ਨਾਲ ਮੈਨੂੰ ਬਹੁਤਾ ਅੱਛਾ ਫੀਲ ਹੋਇਆ ਉਸ ਤੋਂ ਬਾਅਦ ਮੈਂ ਇੱਦਾਂ ਦੇ ਕਈ ਕੰਪੀਟੀਸ਼ਨ ਮਲ ਕਿ ਗਿਆ ਜਿੱਤੇ ਵੀ ਸੱਭਿਆਚਾਰਕ ਮੇਲੇ ਵੱਲ ਸੱਭਿਆਚਾਰਕ ਬਾਰੇ ਬੋਲ ਕੇ ਕਾਫੀ ਇਨਾਮ ਵੀ ਜਿੱਤੇ ਮੈਂ ਸਟੇਜਾਂ 'ਤੇ ਗਿਆ ਮੈਂ ਫਿਰ ਕਈ ਐਸੇ ਸੱਭਿਆਚਾਰ ਪ੍ਰੋਗਰਾਮ ਜਿੱਦਾਂ ਮੇਲੇ ਛਿੰਝ ਮੇਲਾ ਜਾਂ ਕਿੱਦਾਂ ਉੱਥੇ ਵੀ ਮੈਂ ਕਾਫੀ ਪੰਜਾਬੀ ਦੇ ਵਿੱਚ ਭਾਸ਼ਣ ਵਗੈਰਾ ਦਿੱਤਾ ਮੈਨੂੰ ਬਹੁਤ ਵਧੀਆ ਲੱਗਿਆ ਜਨਤਾ ਨੂੰ ਵੀ ਪਸੰਦ ਆਇਆ ਮੇਰਾ ਭਾਸ਼ਣ ਮੈਂ ਮਲ ਕਿ ਬੜਾ ਵਧੀਆ ਬੋਲਣ ਦੇ ਵਿੱਚ ਬਹੁਤ ਵਧੀਆ ਬੋਲੇ ਜਿੱਦਾਂ ਮਲ ਕਿ ਦੁਨੀਆ ਮਹਿਸੂਸ ਕਰਨਾ ਚਾਹੁੰਦੀ ਸੀ ਮੈਨੂੰ ਕਿ ਉੱਦਾਂ ਦੇ ਮੈਂ ਲਫਜ਼ ਬੋਲੇ ਮੈਨੂੰ ਬਹੁਤ ਚੰਗਾ ਲੱਗਿਆ ਓਕੇ ਜੀ ਮੇਰਾ ਅਨੁਭਵ ਬਹੁਤ ਬਹੁਤ ਵਧੀਆ ਸੀ